ਹੈਲੋ ਕੀ ਤੁਸੀਂ ਸਵਿੱਗੀ ਤੋਂ ਬੋਲ ਰਹੇ ਹੋ ਪਾਟਨਰ ਡਿਲੀਵਰੀ ਵਾਲੇ ਹਾਂਜੀ ਤੁਸੀਂ ਸੇਠੀ ਬੇਕਰੀ ਤੋਂ ਚੋਕਲੇਟ ਬਰਾਉਨ ਕੇਕ ਦਾ ਔਡਰ ਲਿਆ ਰਹੇ ਓ ਨਾ ਹਾਂਜੀ ਦਰਅਸਲ ਨਾ ਜਿਹੜਾ ਐਡਰੈੱਸ ਕੀਤਾ ਹੋਇਆ ਹੈ ਉਹ ਆਮ ਖਾਸ ਬਾਗ ਨੇੜੇ ਦੇ ਘਰ ਦਾ ਕਰ ਦਿੱਤਾ ਹੈ ਉਹ ਉਹਨੂੰ ਬਦਲਣਾ ਸੀਗਾ ਹਾਂਜੀ ਉਹ ਐਪ 'ਤੇ ਤਾਂ ਬਦਲ ਦਿੱਤਾ ਪਰ ਸਾਨੂੰ ਉਹੀ ਦਿਖਾ ਰਿਹਾ ਪਰ ਤੁਸੀਂ ਦੁਬਾਰਾ ਪੁਰਾਣੇ ਐਡਰੈੱਸ 'ਤੇ ਹੀ ਜਾ ਰਹੇ ਹੋ ਗੂਗਲ ਮੈਪ ਦੇ ਹਿਸਾਬ ਨਾਲ ਕੀ ਤੁਸੀਂ ਜਿਹੜਾ ਅਪਡੇਟਿਡ ਐਡਰੈੱਸ ਹੈ ਉਹਦੇ ਉੱਤੇ ਆ ਸਕਦੇ ਹੋ ਹਾਂਜੀ ਨਵਾਂ ਪਤਾ ਬਾਬਾ ਬੰਦਾ ਸਿੰਘ ਬਹਾਦਰ ਫਲੈਟ ਜਿਹੜੇ ਨੇ ਸਵਿਮਿੰਗ ਪੂਲ ਦੇ ਨੇੜੇ ਉਹਦਾ ਦੋ ਸੌ ਗਿਆਰਾਂ ਨੰਬਰ ਫਲੈਟ ਹੈ ਪਾਰਕਿੰਗ ਵਾਲੇ ਫਲੈਟਾਂ ਦੇ ਉੱਤੇ ਹਾਂਜੀ ਉਹਤੋ ਪੁੱਠੀ ਡਾਇਰੈਕਸ਼ਨ 'ਚ ਹਾਂਜੀ ਹਾਂਜੀ ਉੱਥੋਂ ਬਸ ਪੰਜ ਕੁ ਮਿੰਟ ਹੀ ਦੂਰ ਹੈ ਠੀਕ ਹੈ ਜੀ